ਇੱਕੀ ਅਗਸਤ ਦੋ ਹਜ਼ਾਰ ਤਿੰਨ ਚੌਵੀ ਨਵੰਬਰ ਦੋ ਹਜ਼ਾਰ ਦਸ ਪੰਦਰ੍ਹਾਂ ਨਵੰਬਰ ਦੋ ਹਜ਼ਾਰ ਇੱਕੀ ਸੋਲ੍ਹਾਂ ਅਗਸਤ ਦੋ ਹਜ਼ਾਰ ਇੱਕ ਅਠਾਰ੍ਹਾਂ ਨਵੰਬਰ ਦੋ ਹਜ਼ਾਰ ਬਾਰ੍ਹਾਂ